ਬਈ ਮੇਰਾ ਇੱਕ ਯਾਰ ਦੋਸਤ ਹੈ ਡੁੱਗਾ ਉਹਨੇ ਮੈਨੂੰ ਸਲਾਹ ਦੇ ਦਿੱਤੀ ਫੋਨ ਦੀ ਨਥਿੰਗ ਦੀ ਪਹਿਲਾਂ ਮੈਂ ਜਾਣੀ ਕਿ ਬਹੁਤ ਸੋਚਿਆ ਫੋਨਾਂ ਬਾਰੇ ਯੂਟਿਊਬ ਪਰ ਵੀਡੀਓ ਦੇਖੀਆਂ ਵੀ ਜਾਣੀ ਕਿ ਮੇਰੀ ਤੀਹ ਕੁ ਹਜ਼ਾਰ ਦੀ ਰੇਂਜ ਤੀ ਵੀ ਇੰਨੇ ਕੁ ਤੀਹ ਕੁ ਹਜ਼ਾਰ ਤੱਕ ਮੈਨੂੰ ਕੋਈ ਫੋਨ ਮਿਲ ਜਾਵੇ ਫਿਰ ਡੁੱਗੇ ਨੇ ਸਲਾਹ ਦੇ ਦਿੱਤੀ ਮੈਨੂੰ ਵੀ ਤੂੰ ਨਥਿੰਗ ਫੋਨ ਵੰਨ ਲੈ ਵੀ ਨਵਾਂ ਆਇਆ ਵਧੀਆ ਚੀਜ਼ ਹੈ ਚਲ ਮੈਨੂੰ ਲੱਗਿਆ ਜਾਣੀ ਕਿ ਉਹ ਬੰਦੇ ਨੂੰ ਹੈ ਜਿਹੀ ਚੀਜ਼ਾਂ ਨੌਲੇਜ ਹੈ ਮੈਂ ਵੀ ਅੱਖਾਂ ਮੀਚ ਕੇ ਉਹਦੇ ਪਰ ਯਕੀਨ ਕਰ ਲਿਆ ਫੋਨ ਔਡਰ ਕਰਤਿਆ ਜੀ ਓਫਰ ਚੱਲਦਾ ਤਾ ਸਾਢੇ ਕੁ ਅਠਾਈ ਹਜ਼ਾਰ 'ਚ ਮੈਨੂੰ ਮਿਲ ਗਿਆ ਅੱਠ ਦੋ ਸੌ ਛਪੰਜਾ ਜਾਣੀ ਕਿ ਅੱਠ ਕੁ ਜੀ ਵੀ ਰੈਮ ਇਹਦੀ ਦੋ ਸੌ ਛਪੰਜਾ ਜੀ ਵੀ ਸਟੋਰੇਜ ਹੈ ਜਾਣੀ ਕਿ ਵਧੀਆ ਹੈਗੀ ਸਟੋਰੇਜ ਵਗੈਰਾ ਤਾਂ ਇਹਦੀ ਇਹੋ ਜਿਹਾ ਕੋਈ ਲਾਂਭਾ ਨਹੀਂ ਇਹਦਾ ਉਹ ਤੋਂ ਇਲਾਵਾ ਕੈਮਰੇ ਵੀ ਵਧੀਆ ਪਰ ਜਿਹੜੀ ਫੋਨ ਦੀ ਲੁੱਕ ਹੈ ਨਾ ਉਹ ਵੱਖਰੀ ਸਭ ਤੋਂ ਪਰ ਸਿਰਾ ਚੀਜ਼ ਆ ਪਿੱਛੇ ਲਾਈਟਾਂ ਜੀਆਂ ਖਾਸੀਆਂ ਬਲਦੀਆਂ ਔਰ ਲੋਕਾਂ ਨੇ ਨਾ ਕਈਆਂ ਨੇ ਹੱਥ ਮ ਫੜ ਫੜ ਦੇਖਿਆ ਲੋਕ ਆਈਫੋਨ ਨੂੰ ਨੀ ਹਾਲੇ ਪੁੱਛਦੇ ਇਹਨਾਂ ਦੇਖਿਆ ਵਾ ਜਿਨਾਂ ਨੇ ਹੱਥਾਂ ਮ ਹੀ ਫੋਨ ਆ ਉਹ ਵੀ ਕਹਿੰਦੇ ਬਾਈ ਇਹ ਦਿਖਾਈ ਕਿਆ ਚੀਜ਼ ਹੈ ਇਹੋ ਜਿਹਾ ਖਤਰਨਾਕ ਫੋਨ ਹੈ ਨਥਿੰਗ ਦਾ ਘੈਂਟ ਚੀਜ਼ ਕਰਾਈ ਬੰਦੇ ਨੇ ਜਾਣੀ ਕਿ ਅੱਤ ਕਰਾਈ ਪਈ ਪੂਰੀ ਵਧੀਆ ਲੱਗਦਾ ਜਾਣੀ ਕਿ ਹੱਥ ਚ ਫੜਿਆ ਵਾ ਫੋਨ ਵੀ ਜੱਚਦਾ ਪ੍ਰੀਮੀਅਮ ਫੀਲ ਆਉਂਦੀ ਪੂਰੀ